ਮਾਮਾ ਦੀ ਕੁੜੀ ਦੇ ਸ਼ਾਦੀ ਵਿੱਚ ਜਾਣ ਲਈ ਮੇਸ਼ੋ 'ਤੇ ਅਸੀਂ ਪੂਰੀ ਫੈਮਿਲੀ ਨੇ ਇੱਕ ਪ ਔਡਰ ਕਰਿਆ ਸੀ ਜਿਸ ਵਿੱਚ ਮੈਂ ਆਪਣੇ ਆਪਣਾ ਪਸੰਦੀਦਾਰ ਕੱਪੜਾ ਟੌਪ ਜੀਨ ਔਡਰ ਕਰਿਆ ਤਾਂ ਸਾਨੂੰ ਇਸ ਗੱਲ ਦਾ ਡਰ ਸੀ ਕਿ ਪਤਾ ਨਹੀਂ ਉਹ ਸਹੀ ਸਮੇਂ 'ਤੇ ਮੇਰੇ ਘਰ ਪਹੁੰਚੇਗਾ ਜਾਂ ਨਾ ਪਹੁੰਚੇਗਾ ਬਟ ਮੇਸ਼ੋ ਵਾਲ ਮੇਸ਼ੋ ਕੰਪਨੀ ਨੇ ਸਹੀ ਸਮੇਂ 'ਤੇ ਮੇਰੇ ਘਰ ਉਹ ਡਿਲੀਵਰ ਪਹੁੰਚਾ ਕੇ ਸਾਨੂੰ ਸੰਤੁਸ਼ਟ ਕਰ ਦਿਆ ਉਹ ਡ੍ਰੈਸ ਵਿੱਚ ਬਿਲਕੁਲ ਸਹੀ ਸਮਾਂ 'ਤੇ ਸਾਡੇ ਘਰ ਪਹੁੰਚਿਆ ਅਤੇ ਉਹ ਦੇਖਣ ਵਿੱਚ ਵੀ ਬਹੁਤ ਸਹੀ ਸੀ ਅਤੇ ਉਹ ਮੇਰੇ ਸਾਈਜ਼ ਦਾ ਵੀ ਸੀ ਮੈਂ ਸ ਐੱਸ ਸਾਈਜ਼ ਦਾ ਮੰਗਵਾਇਆ ਸੀ ਜੋ ਕਿ ਮੇਰੇ 'ਤੇ ਬਿਲਕੁਲ ਪਰਫੈਕਟ ਹੋਇਆ ਅਤੇ ਮੇਰੀ ਭੈਣ ਨੇ ਜੀਨ ਟੌਪ ਅਤੇ ਮੇਰੀ ਦੂਜੀਆਂ ਭੈਣਾਂ ਨੇ ਸੂਟ ਮੰਗਾਇਆ ਸੀ ਜੋ ਕਿ ਉਹਨਾਂ ਦੇ ਸਾਈਜ ਬਿਲਕੁਲ ਪ੍ਰਫੈਕਟ ਸੀ ਅਤੇ ਉਹਨਾਂ ਦੇ ਫੇਵਰਟ ਕਲਰਸ ਜਿਹੜਾ ਮੰਗਾਇਆ ਜਿਵੇਂ ਚਾਹੀਦਾ ਸੀ ਉਵੇਂ ਹੀ ਦਾ ਹੀ ਆਇਆ ਮੈਂ ਸੈਡਲ ਮੰਗਾਏ ਸੀ ਜੋ ਕਿ ਮੈਨੂੰ ਬਿਲਕੁਲ ਪ੍ਰਫੈਕਟ ਹੋਇਆ ਅਤੇ ਮੇਰੀ ਭੈਣ ਨੇ ਸੂਜ਼ ਮੰਗਵਾਏ ਸੀ ਜੋ ਕਿ ਉਹਨਾਂ ਨੂੰ ਵੀ ਬਿਲਕੁਲ ਪ੍ਰਫੈਕਟ ਹੋਇਆ ਅਤੇ ਮੇਰੀ ਫੈਮਿਲੀਜ਼ ਦੇ ਜਿੰਨਾ ਵੀ ਅਸੀਂ ਜੋ ਵੀ ਔਡਰ ਕਰਿਆ ਉਹ ਬਿਲਕੁਲ ਪ੍ਰਫੈਕਟ ਮਿਲਿਆ ਸਾਨੂੰ ਮੈਂ ਧੰਨਵਾਦ ਕਰਨਾ ਚਾਹੁੰਗੀ ਮੇਸ਼ੋ ਦਾ ਕਿ ਇੰਨਾਂ ਅੱਛਾ ਉਹ ਸਾਨੂੰ ਪ੍ਰੋਡਕਟ ਉਹਨਾਂ ਨੇ ਦਿੱਤਾ ਜੋ ਕਿ ਸਾਨੂੰ ਬਿਲਕੁਲ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਪਈ ਅਤੇ ਉਹ ਬਿਲਕੁਲ ਸਹੀ ਸਮੇਂ 'ਤੇ ਸਾਡੇ ਘਰ ਪਹੁੰਚ ਗਿਆ ਮੇਸ਼ੋ ਕੰਪਨੀ ਦਾ ਸਾਨੂੰ ਸ ਸ ਸਾਰੇ ਸਮਾਨ ਸਹੀ ਦਿੱਤੇ